ਸਾਡੀ ਸੱਭਿਆਚਾਰਕ ਪਛਾਣ ਜੋ ਬਣਾਈ ਹੈ ਉਹ ਸਾਡੀ ਸੇਵਾ ਦੀ ਭਾਵਨਾ ਨੇ ਬਣਾਈ ਹੈ ਸਾਨੂੰ ਇਹ ਸੇਵਾ ਦੀ ਭਾਵਨਾ ਦਾ ਜੋ ਜਜ਼ਬਾ ਮਿਲਿਆ ਹੈ ਉਹ ਉਸ ਪਿੱਛੇ ਜੋ ਮਹਾਨ ਸ਼ਖਸੀਅਤ ਹਨ ਉਹ ਭਾਈ ਘਨੱਈਆ ਜੀ ਹਨ ਭਾਈ ਘਨੱਈਆ ਜੀ ਦੀ ਸ਼ਖਸੀਅਤ ਤੋਂ ਸਭ ਨੇ ਪ੍ਰੇਰਨਾ ਲਈ ਹੈ ਜੋ ਸਾਡੇ ਭਾਈਚਾਰੇ ਵਿੱਚੋਂ ਹੀ ਹੋਏ ਹਨ ਇਹ ਇੱਕ ਬਹੁਤ ਹੀ ਪੁਰਾਣੀ ਇਤਿਹਾਸਿਕ ਘਟਨਾ ਹੈ ਜੋ ਕਿ ਸ਼ਾਇਦ ਸਾਰੇ ਪੰਜਾਬ ਨੂੰ ਸਾਰੀ ਦੁਨੀਆਂ ਨੂੰ ਪਤਾ ਹੈ ਪਰ ਫਿਰ ਵੀ ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਭਾਈ ਘਨੱਈਆ ਜੀ ਸਾਡੇ ਇਲਾਕੇ ਦੇ ਹੋਏ ਨੇ ਭਾਈ ਘਨੱਈਆ ਜੀ ਗੁਰੂ ਸਾਹਿਬ ਦੇ ਨਾਲ ਜੰਗ ਦੇ ਮੈਦਾਨਾਂ ਵਿੱਚ ਜਾਂਦੇ ਰਹੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹ ਰਹੇ ਅਤੇ ਜਿੰਨੀਆਂ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨਾਲ ਜਾਂ ਮੁਗਲਾਂ ਨਾਲ ਲੜਾਈਆਂ ਲੜੀਆਂ ਉਸ ਵਿੱਚ ਭਾਈ ਘਨੱਈਆ ਜੀ ਉਹਨਾਂ ਦੇ ਸਾਥੀ ਵਜੋਂ ਵਿਚਰੇ ਨੇ ਭਾਈ ਘਨੱਈਆ ਜੀ ਜੋ ਸੇਵਾ ਦੇ ਪੁੰਜ ਵਜੋਂ ਜਾਣੇ ਜਾਂਦੇ ਨੇ ਉਹਨਾਂ ਨੇ ਜਖਮੀ ਹੋਏ ਸਿਪਾਹੀਆਂ ਦੀ ਮਲ੍ਹਮ ਪੱਟੀ ਕਰਨੀ ਸੀ ਉਹਨਾਂ ਨੂੰ ਪਾਣੀ ਪਿਆਉਣਾ ਸੀ ਇਹ ਕੰਮ ਉਹਨਾਂ ਨੇ ਆਪ ਦੇ ਜ਼ਿੰਮੇਵਾਰੀ ਲਈ ਉਹ ਜ ਜੰਗ ਵਿੱਚ ਜਖਮੀ ਹੋਏ ਸਿੱਖਾਂ ਨੂੰ ਸਿਪਾਹੀਆਂ ਨੂੰ ਪਾਣੀ ਪਿਆਉਂਦੇ ਸੀ ਇੱਕ ਵਾਰ ਮੁਗਲਾਂ ਨਾਲ ਕਾਫੀ ਭਿਆਨਕ ਲੜਾਈ ਚੱਲ ਰਹੀ ਸੀ ਉਸ ਵਿੱਚ ਉਹਨਾਂ ਨੇ ਦੇਖਿਆ ਕਿ ਦੁਸ਼ਮਣਾਂ ਦੇ ਕੁਝ ਸਿਪਾਹੀ ਵੀ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਕੇ ਪਾਣੀ ਪਾਣੀ ਚੀਕ ਰਹੇ ਹਨ ਪਾਣੀ ਮੰਗ ਰਹੇ ਹਨ ਭਾਈ ਘਨੱਈਆ ਜੀ ਜੋ ਕਿ ਸੇਵਾ ਦੇ ਪੁੰਜ ਸੀਗੇ ਉਹਨਾਂ ਨੂੰ ਹਰ ਇਨਸਾਨ ਵਿੱਚੋਂ ਪਰਮਾਤਮਾ ਦਿਖਦਾ ਸੀ ਉਹਨਾਂ ਨੇ ਦੁਸ਼ਮਣ ਦੇ ਸਿਪਾਹੀਆਂ ਨੂੰ ਵੀ ਪਾਣੀ ਪਿਆਉਣਾ ਸ਼ੁਰੂ ਕਰ ਦਿੱਤਾ ਇਹ ਦੇਖ ਕੇ ਅਪ ਇਹਨਾਂ ਦੀ ਆਪਣੀ ਫੌਜ ਦੇ ਬੰਦੇ ਗੁਰੂ ਸਾਹਿਬ ਕੋਲ ਇਹਨਾਂ ਦੀ ਸ਼ਿਕਾਇਤ ਲੈ ਕੇ ਗਏ ਵੀ ਗੁਰੂ ਜੀ ਅਸੀਂ ਤਾਂ ਉਹਨਾਂ ਨੂੰ ਮਸਾਂ ਮਾਰ ਕੇ ਸਿੱਟਦੇ ਹਾਂ ਇਹ ਆਪਣਾ ਬੰਦਾ ਉਹਨਾਂ ਨੂੰ ਜਾ ਕੇ ਪਾਣੀ ਪਿਆ ਰਿਹਾ ਉਹ ਫਿਰ ਉੱਠ ਕੇ ਸਾਡੇ ਨਾਲ ਲੜਨ ਜੋਗੇ ਹੋਈ ਜਾਂਦੇ ਨੇ ਗੁਰੂ ਸਾਹਿਬ ਨੇ ਭਾਈ ਘਨੱਈਆ ਨੂੰ ਬੁਲਾਇਆ ਕਹਿੰਦੇ ਭਾਈ ਸਾਹਿਬ ਤੁਹਾਡੀ ਸ਼ਿਕਾਇਤ ਆਈ ਆ ਵੀ ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਪੈ ਕੇ ਕਾਇਮ ਕਰੀ ਜਾਂਦੇ ਹੋ ਤਾਂ ਭਾਈ ਘਨੱਈਆ ਜੀ ਨੇ ਇੰਨਾਂ ਵਧੀਆ ਜਵਾਬ ਦਿੱਤਾ ਕਿ ਗੁਰੂ ਸਾਹਿਬ ਵੀ ਉਹਨਾਂ ਦੇ ਕਾਇਲ ਹੋ ਗਏ ਭਾਈ ਘਨੱਈਆ ਜੀ ਕਹਿੰਦੇ ਗੁਰੂ ਸਾਹਿਬ ਮੈਂ ਪੈਣੀ ਮੈਂ ਜੋ ਪਾਣੀ ਪਿਆ ਰਿਹਾ ਉਹ ਦੁਸ਼ਮਣ ਦੇ ਸਿਪਾਹੀਆਂ ਨੂੰ ਨਹੀਂ ਪਿਆ ਰਿਹਾ ਮੈਂ ਤਾਂ ਹਰੇਕ ਸਿਪਾਹੀ ਦੇ ਵਿੱਚੋਂ ਤੁਹਾਡੀ ਸ਼ਕਲ ਦਿਖ ਰਹੀ ਹੈ ਜੋ ਵੀ ਕੋਈ ਚੀਕਦਾ ਹੈ ਚਲਾਉਂਦਾ ਹੈ ਜਾਂ ਮਦਦ ਮੰਗਦਾ ਹੈ ਮੈਨੂੰ ਤਾਂ ਤੁਹਾਡੇ ਦਰਸ਼ਨ ਹੋ ਰਹੇ ਨੇ ਮੈਨੂੰ ਤਾਂ ਇਹ ਲੱਗਦਾ ਹੀ ਨਹੀਂ ਓ ਉਹ ਦੁਸ਼ਮਣ ਦੇ ਬੰਦੇ ਨੇ ਮੈਨੂੰ ਤਾਂ ਇਹ ਲੱਗਦਾ ਵੀ ਉਹ ਵੀ ਮੇਰਾ ਹੀ ਕੋਈ ਭਰਾ ਹੈ ਮੇਰੇ ਹੀ ਗੁਰੂ ਹੈ ਮੇਰੇ ਹੀ ਸਾਥੀ ਹੈ ਗੁਰੂ ਸਾਹਿਬ ਬਹੁਤ ਖੁਸ਼ ਹੋਏ ਕਹਿੰਦੇ ਵੀ ਤੇਰੀ ਸੇਵਾ ਭਾਵਨਾ ਸਭ ਤੋਂ ਉੱਤਮ ਹੈ ਗੁਰੂ ਸਾਹਿਬ ਨੇ ਮਲ੍ਹਮ ਮੰਗਾ ਕੇ ਦਿੱਤੀ ਕਹਿੰਦੇ ਆ ਲੈ ਭਾਈ ਘਨੱਈਆ ਲੜਾਈ ਕਰਨਾ ਸਾਡਾ ਧਰਮ ਹੈ ਅਸੀਂ ਉਹ ਕਰੀ ਜਾਣੀ ਹੈ ਸਾਡੇ ਸਿਪਾਹੀਆਂ ਨੇ ਕਰੀ ਜਾਣੀ ਹੈ ਸੇਵਾ ਕਰਨਾ ਤੇਰਾ ਧਰਮ ਹੈ ਆਹ ਲੈ ਮਲ੍ਹਮ ਹੁਣ ਜੋ ਵੀ ਜਖਮੀ ਹੁੰਦਾ ਉਹਦੇ ਨਾਲ ਮਲ੍ਹਮ ਪੱਟੀ ਵੀ ਕਰ ਦਿਆ ਕਰ ਇੰਨੀ ਮਹਾਨ ਸ਼ਖਸੀਅਤ ਸਾਡੇ ਵਿੱਚੋਂ ਹੋਈ ਹੈ ਜਿਸ ਘਟਨਾ 'ਤੇ ਸਾਨੂੰ ਬਹੁਤ ਮਾਣ ਹੈ ਅਤੇ ਉਹਨਾਂ ਨੇ ਸਾਡੇ ਸੱਭਿਆਚਾਰ ਨੂੰ ਹੋਰ ਵੀ ਅਮੀਰ ਕੀਤਾ ਹੈ ਜਿਦਾਂ ਕਿ ਸਾਡੇ ਵਿੱਚ ਸੇਵਾ ਭਾਵਨਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਬਣੀ ਹੋਈ ਹੈ ਅਤੇ ਸਾਰੀ ਦੁਨੀਆਂ ਵਿੱਚ ਅਸੀਂ ਮਸ਼ਹੂਰ ਹਾਂ